ਚੋਣਾਂ ਦੌਰਾਨ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੇਖੋ ਮੇਰ ਨੇ ਮੈਨੂੰ ਜਿਹੜੀ ਸਭ ਤੋਂ ਜ਼ਿਆਦਾ ਬੜੀ ਮੁਸ਼ਕਲ ਲੱਗਦੀ ਹੈ ਕਿ ਹੈ ਕਿ ਚੋਣਾਂ ਦੇ ਟਾਈਮ ਬੜੀ ਲੰਬੀ ਲੰਬੀ ਲਾਈਨਾਂ ਲੱਗ ਜਾਂਦੀਆਂ ਨੇ ਉਸਦਾ ਇਹ ਕਾਰਨ ਹੈ ਕਿ ਘੱਟ ਬੂਥ ਬਣਾਏ ਜਾਣ ਘੱਟ ਬੂਥ ਬਣਾਏ ਜਾਂਦੇ ਨੇ ਸਰਕਾਰ ਜਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦੁਆਰਾ ਘੱਟ ਬੂਥ ਜਿਹੜੇ ਬਣਾਏ ਜਾਂਦੇ ਨੇ ਉਸ ਦੇ ਕਾਰਨ ਕਿਆ ਹੁੰਦਾ ਕਿ ਆਪਣਾ ਨੂੰ ਬਹੁਤ ਟਾਈਮ ਲੱਗਦਾ ਹੁਣ ਜੇ ਕੋਈ ਕੰਮ ਕਾਰ ਵਾਲਾ ਬੰਦਾ ਜਿਸ ਨੇ ਛੇਤੀ ਛੇਤੀ ਵੋਟ ਪਾ ਕੇ ਜਾਣਾ ਉਹਨੂੰ ਦੋ ਤਿੰਨ ਘੰਟੇ ਉੱਥੇ ਵੇਟ ਕਰਨਾ ਪੈ ਜਾਂਦਾ ਜਿਸ ਕਰਕੇ ਆਪਣੀ ਇਸਦਾ ਹੀ ਜਿਹੜਾ ਇਫੈਕਟ ਹੈ ਸਿੱਧਾ ਸਿੱਧਾ ਆਪਣੀ ਚੋਣਾਂ 'ਤੇ ਹੀ ਪੈਂਦਾ ਹੁਣ ਜੇ ਕੋਈ ਸਰਕਾਰੀ ਨੌਕਰੀ ਜਾਂ ਕੋਈ ਵੀ ਪ੍ਰਾਈਵੇਟ ਜੋਬ ਵਾਲਾ ਬੰਦਾ ਜਿਹਨੇ ਜਲਦੀ ਜਾਣਾ ਤਾਂ ਉਹ ਉਹਨੂੰ ਪਤਾ ਕਿ ਬੂਥ ਘੱਟ ਨੇ ਲਾਈਨ ਵਿੱਚ ਖੜ੍ਹਨਾ ਪੈਣਾ ਲਾਈਨ ਵਿੱਚ ਖੜ੍ਹਨ ਦੇ ਕਾਰਨ ਦੋ ਤਿੰਨ ਘੰਟੇ ਵੇਸਟ ਹੋ ਜਾਣਗੇ ਜਿਸ ਕਰਕੇ ਕਿਆ ਉਹ ਬੰਦਾ ਵੋਟ ਪਾਉਣ ਜਾਂਦਾ ਹੀ ਨਹੀਂ ਜਿਸ ਦੇ ਕਾਰਨ ਸਾਡੇ ਦੇਸ਼ ਦੀ ਜਿਹੜੀ ਵੋਟ ਪਰਸੈਂਟ ਹੈ ਵੋਟਿੰਗ ਪਰਸੈਂਟੇਜ ਹੈ ਉਹ ਘੱਟ ਰਹੀ ਹੈ ਤਾਂ ਮੈਨੂੰ ਇਹੀ ਹੈ ਕਿ ਗੋਰਮੈਂਟ ਨੂੰ ਚਾਹੀਦਾ ਕਿ ਜ਼ਿਆਦਾ ਤੋਂ ਜ਼ਿਆਦਾ ਬੂਥ ਉਹ ਬਣਾਏ ਜਾਣ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕੋਈ ਇਹੋ ਜਿਹੀ ਗੱਲ ਹੈ ਨਹੀਂ